ਜਿਵੇਂ ਜਿਵੇਂ ਇਸ ਸਮੇਂ ਦੌਰਾਨ ਜ਼ਮੀਨਾਂ ਦੇ ਰੇਟ ਜਿਹੜੇ ਨੇ ਜ਼ਮੀਨਾਂ ਦੀ ਜਿਹੜੀ ਕੀਮਤ ਹੈ ਉਹ ਉੱਚੀਆਂ ਮੰਜਿਲਾਂ 'ਤੇ ਗਈ ਹਾਂ ਉਸੇ ਤਰਾਂ ਅੱਜ ਕੱਲ੍ਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਲਾਲਚ ਵੀ ਵੱਧ ਗਿਆ ਹੈ ਜਿਵੇਂ ਕਿ ਕਿਸੇ ਵੀ ਪਿਤਾ ਦੇ ਸਮਝ ਲਓ ਦੋ ਪੁੱਤਰ ਨੇ ਧੀਆਂ ਨੇ ਅੱਜ ਕੱਲ੍ਹ ਪਹਿਲੀ ਗੱਲ ਤਾਂ ਧੀਆਂ ਵੀ ਦਹੇਜ ਵਗੈਰਾ ਲੈਣ ਤੋਂ ਬਾਅਦ ਵੀ ਲਾਲਚ ਕਾਰਨ ਆਪਣਾ ਹੱਕ ਆਪਣੇ ਆਪਣੇ ਭਰਾਵਾਂ ਦੀ ਜ਼ਮੀਨ ਦੇ ਵਿੱਚ ਹੱਕ ਮੰਗਦੀਆਂ ਨੇ ਸਮਝ ਲਓ ਕਿ ਇਸ ਜ਼ਮੀਨਾਂ ਹੈ ਜਿਹੜੀਆਂ ਨੇ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਵਧੀ ਹੋਈ ਆ ਅਤੇ ਇਹ ਜਿਹੜੇ ਭਰਾ ਨੇ ਆਪਸੀ ਭਰਾਵਾਂ ਦਾ ਜਿਹੜਾ ਵੀ ਇੱਕ ਪਿਆਰ ਵਾਲਾ ਰਿਸ਼ਤਾ ਸੀਗਾ ਉਹਨਾਂ 'ਚ ਵੀ ਬਹੁਤ ਜ਼ਿਆਦਾ ਕੜਵਾਹਟ ਆ ਗਈ ਇਸ ਜਦ ਵੀ ਕੋਈ ਜ਼ਮੀਨਾਂ ਦੇ ਝਗੜੇ ਹੁੰਦੇ ਨੇ ਪਹਿਲੀ ਗੱਲ ਕੀ ਹੁੰਦਾ ਹੈ ਕਿ ਆਪਸੀ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਨੇ ਪਰਿਵਾਰ ਦੇ ਉਹ ਆਪਣੇ ਭਰਾਵਾਂ ਦੀ ਲੜਾਈ ਜ਼ਮੀਨੀ ਲੜਾਈ ਜਿਹੜੀ ਕਿ ਅੱਜ ਕੱਲ੍ਹ ਜ਼ਮੀਨਾਂ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ ਉਹਦੇ ਉਹਨਾਂ ਕਰਕੇ ਜਿਹੜੇ ਝਗੜੇ ਵਧੇ ਨੇ ਉਹਨਾਂ ਨੂੰ ਸਮਝਾਉਣ ਦੀ ਉਹਨਾਂ ਨੂੰ ਸਹੀ ਕਰਨੇ ਦੀ ਬਰਾਬਰ ਬਰਾਬਰ ਜ਼ਮੀਨ ਵੰਡਣ ਦੇ ਨਾਲ ਜਿਹੜੇ ਵੀ ਵੱਡੇ ਰਿਸ਼ਤੇਦਾਰ ਨੇ ਉਹਨਾਂ ਦੀ ਸਹਿਮਤੀ ਨਾਲ ਵ ਜ਼ਮੀਨਾਂ ਵੰਡੀਆਂ ਜਾਂਦੀਆਂ ਨੇ ਜੇ ਸਮਝ ਲਓ ਉਸ ਉਹਨਾ ਜਿਹੜੇ ਵੱਡੇ ਰਿਸ਼ਤੇਦਾਰ ਨੇ ਵੱਡੇ ਬਜ਼ੁਰਗ ਆ ਉਹਨਾਂ ਦੀ ਸਹਿਮਤੀ ਦੇ ਨਾਲ ਵੀ ਫੇਰ ਵੀ ਜੇ ਕੋਈ ਉਨ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਉਹ ਫੇਰ ਪੰਚਾਇਤ ਦੇ ਕੋਲ ਜਾ ਕੇ ਆਪਣੇ ਪੱਖ ਰੱਖਦੇ ਨੇ ਅਤੇ ਫੇਰ ਵੀ ਜਦੋਂ ਪੰਚਾਇਤ ਫੈਸਲਾ ਕਰਦੀ ਹੈ ਉਸ ਫੇ ਫੈਸਲੇ ਦੇ ਉੱਪਰ ਵੀ ਜੇ ਕੋਈ ਵੀ ਇੱਕ ਬੰਦਾ ਦੋਨਾਂ ਭਰਾਵਾਂ 'ਚੋਂ ਸਮਝ ਲਓ ਇੱਕ ਬੰਦਾ ਨਹੀਂ ਖੜਦਾ ਫੇਰ ਉਹ ਕਾਨੂੰਨੀ ਲੜਾਈ ਦੇ ਵਿੱਚ ਜਾਂਦਾ ਏ ਤੇ ਜਿਹੜੀਆਂ ਵੀ ਨਿਆਂਏ ਅਦਾਲਤਾਂ ਨੇ ਉਹਨਾਂ ਦੇ ਵਿੱਚ ਆਪਣੀ ਜ਼ਮੀਨੀ ਜ਼ਮੀਨ ਦੇ ਕੇਸ ਫਾਇਲ ਕਰਦਾ ਹੈ ਅਤੇ ਜਿਹੜੇ ਕੇਸ ਨੇ ਕਾਫੀ ਲੰਬਾ ਸਿਰ ਚੱਲਦੇ ਨੇ ਕਿਉਂਕਿ ਜਿਹੜੇ ਜੱਜ ਸਹਿਬਾਨਾਂ ਨੇ ਉਹਨਾਂ ਨੇ ਵੀ ਸਾਰਾ ਕੁਛ ਦੇਖ ਪਰਖ ਕੇ ਦੇਖ ਪਰਖ ਕੇ ਉਸਦਾ ਫੈਸਲਾ ਕਰਨਾ ਹੁੰਦਾ ਹੈ ਅਤੇ ਜਦੋਂ ਦੇਖ ਪਰਖ ਕੇ ਫੈਸਲਾ ਕਰਦੇ ਨੇ ਤਾਂ ਇੱਕ ਦਾ ਇੱਕ ਵੱਲ ਇੱਕ ਬੰਦਾ ਕੇਸ ਜਿੱਤ ਜਾਂਦਾ ਅਤੇ ਇੱਕ ਹਾਰ ਜਾਂਦਾ ਹੈ ਜਿਹੜਾ ਹਾਰਿਆ ਹੋਇਆ ਬੰਦਾ ਹੈ ਉਹਦੇ ਕੋਲ ਇੱਕ ਹੋਰ ਸਹੂਲਤ ਹੁੰਦੀ ਹੈ ਕਿ ਉਹ ਉੱਚੀ ਜਿਹੜੀ ਉੱਚੀ ਅਦਾਲਤ ਆ ਉਹਦੇ ਵਿੱਚ ਅਪੀਲ ਫਾਈਲ ਕਰ ਸਕਦਾ ਹੈ ਅਤੇ ਇਹ ਇਹ ਜਿਹੜੇ ਝਗੜੇ ਨੇ ਜੀ ਇਹ ਬਹੁਤ ਲੰਬੇ ਸਮੇਂ ਤੱਕ ਚੱਲਦੇ ਜਾਂਦੇ ਨੇ ਇਹ ਇਹਨਾਂ ਦੇ ਲੰਬੇ ਸਮੇਂ ਹਾਈ ਹੀ ਇਸ ਤੋਂ ਬਾਅਦ ਜੇ ਸਮਝ ਲਓ ਛੋਟੀ ਕੋਰਟ ਦੇ ਵਿੱਚ ਕੋਈ ਕੇਸ ਫਾਈਲ ਕੀਤਾ ਹੈ ਤਾਂ ਫੇਰ ਡਿਸਟਿਕ ਜ਼ਮੀਨੀ ਕੇਸ ਤਾਂ ਡਿਸਟਿਕ ਜੱਜ ਕੋਲ ਅਪੀਲ ਪੈਂਦੀ ਆ ਜੇ ਉੱਥੇ ਇੱਕ ਪਾਰਟੀ ਜਿਹੜੀ ਜੇ ਕਿਸੇ ਨੂੰ ਫੇਰ ਬਲੋ ਪ੍ਰੋਬਲਮ ਆ ਜੇ ਉਸ ਫੈਸਲੇ ਤੋਂ ਸਹਿਮਤ ਨਹੀਂ ਹੈਗਾ ਫੇਰ ਉਹ ਹਾਈ ਕੋਰਟ ਚਲੇ ਜਾਂਦਾ ਹੈ ਅਪੀਲ ਦਾਇਰ ਕਰਦਾ ਹੈ ਹਾਈ ਕੋਰਟ ਅਪੀਲ ਦਾਇਰ ਕਰਨ ਤੋਂ ਬਾਅਦ ਫਿਰ ਸੁਪਰੀਮ ਕੋਰਟ ਸੁਪਰੀਮ ਕੋਰਟ ਜਿਹੜਾ ਹੈ ਉਹ ਉਸ ਫੈਸਲੇ ਦੀ ਕੋਈ ਅਪੀਲ ਨਹੀਂ ਪੈਂਦੀ ਹੈਗੀ ਤਾਂ ਫੇਰ ਇਹ ਮਿਜੋ ਜੋ ਕਿ ਮੇਰਾ ਸੁਝਾਅ ਹੈ ਕਿ ਇਹ ਜਿਹੜੇ ਫੈਸਲੇ ਨੇ ਇਹਨਾਂ ਨੂੰ ਘਾਟਾ ਵਾਧਾ ਪੂਰਾ ਕਰਕੇ ਆਪਸ ਵਿੱਚ ਹੀ ਸਹਿਮਤੀ ਕਰ ਲੈਣੀ ਚਾਹੀਦੀ ਹੈ ਇਸ ਤੋਂ ਵੱਡੀ ਕੋਈ ਸਹੀ ਚੀਜ਼ ਨਹੀਂ ਹੈਗੀ ਜੋੜੇ ਸਹਿਮਤੀ ਹਾਂ ਉਹ ਬਹੁਤ ਵਧੀਆ ਚੀਜ਼ ਆ ਸਹਿਮਤੀ ਦੇ ਨਾਲ ਜੋ ਵੀ ਤੁਹਾਡਾ ਇੰਨਾ ਲੰਬਾ ਸਮਾਂ ਆਉਂਦਾ ਹੈ ਉਹਦੀ ਬਚੋ ਹੁੰਦੀ ਹੈ ਜੋ ਵੀ ਪੈਸਾ ਖਰਚ ਹੰਦਾ ਹੈ ਉਸਦੀ ਵੀ ਬੱਚਤ ਹੁੰਦੀ ਹੈ ਸਹਿਮਤੀ ਦੇ ਨਾਲ ਆਪਣੀ ਘੱਟ ਵੱਧ ਜਰਕੇ ਹੀ ਫੈਸਲਾ ਕਰਕੇ ਸੰਤੁਸ਼ਟ ਰਹਿਣਾ ਚਾਹੀਦਾ ਹੈ